ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਮੈਂ ਨਾ ਸੌਰਵ ਮੈਦਾਨ ਬੋਲਣ ਦਿਆਂ ਅਸੀਂ ਨਾ ਦਿੱਲੀ ਤੋਂ ਆਏ ਹਾਂ ਅਤੇ ਮੇਰੀ ਜਾਣ ਪਹਿਚਾਣ ਵਾਲੇ ਨੇ ਨਾ ਤੁਹਾਡਾ ਨੰਬਰ ਦਿੱਤਾ ਵਾ ਮੇਰੇ ਕੋਲ ਨਾ ਆਲਟੋ ਗੱਡੀ ਆ ਅਤੇ ਉਹ 'ਤੇ ਦਿੱਲੀ ਦੀ ਨੰਬਰ ਪਲੇਟ ਲੱਗੀ ਆ ਅਤੇ ਹੁਣ ਪੰਜਾਬ 'ਚ ਆਏ ਤਾਂ ਨੰਬਰ ਇੱਥੋਂ ਦਾ ਚਾਹੀਦਾ ਸੀਗਾ ਤਾਂ ਕੋਈ ਫੋਰਮੈਟ ਦੱਸੋ ਇਹਨੂੰ ਚੇਂਜ ਕਰਾਉਣ ਦਾ ਨੰਬਰ ਇਹ ਮੇਰਾ ਬਹੁਤ ਹੀ ਕਰੀਬੀ ਦੋਸਤ ਹੈਗਾ ਵਾ ਇੱਥੇ ਤੁਹਾਡੇ ਲਾਗੇ ਉਹ ਮੇਰੇ ਖਿਆਲ ਨਾਲ ਤੁਸੀਂ ਇਕੱਠੇ ਕੰਮ ਕਰਦੇ ਰਹੇ ਕਿ ਤੁਹਾਡੇ ਵੀ ਯਾਰ ਬੇਲੀ ਆ ਉਹ ਹਾਂਜੀ ਹਾਂਜੀ ਹਾਂਜੀ ਸਾਨੂੰ ਮਹੀਨੇ ਦੇ ਲਾਗੇ ਸ਼ਾਗੇ ਹੋ ਗਿਆ ਵਾ ਹਾਂਜੀ ਅਤੇ ਫਿਰ ਉਹ ਤੰਗੀ ਆਉਂਦੀ ਹੁਣ ਕੰਮ ਵੀ ਇੱਥੇ ਸੈਟਲ ਹੋ ਗਿਆ ਵਾ ਇੱਤੇ ਫਿਰ ਅਸੀਂ ਕਿਹਾ ਕਿ ਅਸੀਂ ਰਜਿਸਟਰੇਸ਼ਨ ਨੰਬਰ ਗੱਡੀ ਦਾ ਚੇਂਜ ਕਰਾ ਕੇ ਪੰਜਾਬ ਦਾ ਹੀ ਪਾ ਲਈਏ ਅੱਛਾ ਅੱਛਾ ਅੱਛਾ

ਅਤੇ ਐਪਲੀਕੇਸ਼ਨ ਹੈਂਡਰਿਟਨ ਵੀ ਕੋਈ ਫੋਮ ਫੂਮ ਭਰਨਾ ਅੱਛਾ ਹਮ ਅੱਛਾ ਅੱਛਾ ਅੱਛਾ ਅੱਛਾ ਅਸਾਨੀ ਨਾਲ ਹੀ ਹੋਜੂ ਨਾ ਕੋਈ ਤੰਗੀ ਵਗੈਰਾ ਤਾਂ ਨਹੀਂ ਆਉਗੀ

ਗੱਡੀ ਦੇ ਸਾਰੇ ਕਾਗਜ਼ ਲੈ ਜਾਈਏ ਚਲੋ ਠੀਕ ਹੈ ਜੇ ਫਿਰ ਵੀ ਕੋਈ ਤੰਗੀ ਆਵੇ ਤੁਹਾਨੂੰ ਦੁਬਾਰਾ ਫੋਨ ਕਰ ਲਈਏ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਜੀ ਓਕੇ ਸਤਿ ਸ਼੍ਰੀ ਅਕਾਲ ਜੀ